ਮੈਂ ਜੀ ਨਾਲ ਮੇਰੇ ਦੋਸਤਾਂ ਨੇ ਖਾਲਸਾ ਟੈਕਸੀ ਸਟੈਂਡ ਤੋਂ ਇੱਕ ਟੈਕਸੀ ਬੁੱਕ ਕਰੀ ਤੀ ਪਿਛਲੇ ਸੱਤ ਤਰੀਕ ਨੂੰ ਆਪਾਂ ਜੀ ਸ਼ਿਮਲੇ ਨੂੰ ਜਾਣਾ ਤਾ ਉਹ ਜ ਜਦ ਉਹ ਬੰਦਾ ਆਇਆ ਤੁਹਾਡਾ ਡਰਾਈਵਰ ਆਇਆ ਸਾਡੇ ਕੋਲ ਜਦ ਆਪਾਂ ਉਹਨਾਂ ਦੀ ਗੱਡੀ 'ਚ ਬੈਠੇ ਆਪਾਂ ਜਦ ਤਾਕੀ ਖੋਲ੍ਹੀ ਐਡੇ ਜ਼ਿਆਦਾ ਮੁਸ਼ਕ ਆ ਰਹੀ ਤੀ ਜਾਂ ਤਾਂ ਤੁਹਾਡਾ ਡਰਾਈਵਰ ਉਹ ਗੱਡੀ ਨੂੰ ਧੋ ਕੇ ਨਹੀਂ ਲੈ ਕੇ ਆਇਆ ਤਾ ਜਾਂ ਤਾਂ ਸਫਾਈ ਨਹੀਂ ਰੱਖੀ ਤੀ ਇਹ 'ਚ ਪਤਾ ਨਹੀਂ ਕਿਸ ਚੀਜ਼ ਦੀ ਮੁਸ਼ਕ ਆ ਰਹੀ ਤੀ ਜਦ ਆਪਾਂ ਉਹ 'ਚ ਬਹਿ ਕੇ ਥੋੜ੍ਹਾ ਟਾਈਮ ਚਾਰ ਪੰਜ ਕਿਲੋ ਦਸ ਕਿਲੋਮੀਟਰ ਅੱਗੇ ਗਏ ਉਹ ਪੈਂਚਰ ਹੋ ਗਿਆ ਉੱਥੇ ਕੋਈ ਨੇੜੇ ਤੇੜੇ ਨਾ ਕੋਈ ਪੈਂਚਰ ਲਾਉਣ ਵਾਲਾ ਮਿਲ ਰਿਹਾ ਤਾ ਪੈਂਚਰ ਬੜੀ ਔਖੇ ਲਵਾਇਆ ਜੀ ਉਹ ਤੋਂ ਬਾਅਦ ਜਦ ਗਏ ਰਾਤ ਹੋਈ ਹੌਲੀ ਹੌਲੀ ਉੱਧਰ ਲੈਟ 'ਚ ਪ੍ਰੋਬਲਮ ਆ ਗਈ ਤੁਹਾਡੇ ਲੈਟ ਵੀ ਤੁਹਾਡੀ ਬਹੁਤ ਹੌਲੀ ਚੱਲ ਰਿਹਾ ਤਾ ਪਹਾੜੀ ਏਰੀਆ ਜੀ ਉੱਧਰ ਇਸ ਕਰਕੇ ਬਹੁਤ ਜ਼ਿਆਦਾ ਔਖਾ ਹੋਇਆ ਗੱਡੀ ਦਾ ਬਹੁਤ ਸਾਨੂੰ ਉਹ ਨੁਕਸਾਨ ਏ ਹੋਇਆ ਜੀ ਕੋਈ ਫਾਇਦਾ ਨਹੀਂ ਹੋਇਆ ਉਹਦਾ ਉਸ ਗੱਡੀ 'ਚ ਜੀ ਬਹੁਤ ਭਰਵਾਈ ਕਰਨੀ ਏ ਸਾਡਾ ਫੀਡਬੈਕ ਹੈ ਜੀ ਇਸ ਤਰ੍ਹਾਂ ਕੋਈ ਗੱਡੀ ਤੁਹਾਡੇ ਲੈ ਕੇ ਨਹੀਂ ਜਾਊਂਗਾ ਜੀ ਉਸ ਗੱਡੀ 'ਚ ਬਹੁਤ ਜ਼ਿਆਦਾ ਕੰਮ ਕਰਵਾਉਣ ਵਾਲਾ ਤਾ ਲੈਟਾਂ ਬਹੁਤ ਧੁੰਦਲੀਆਂ ਧੁੰਦਲੀਆਂ ਤੀਆਂ ਇਹਦਾ ਖਾਸ ਧਿਆਨ ਰੱਖਿਓ ਜੀ ਬਸ ਧੰਨ